ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੱਸੋ ਕੀ ਹਾਲ ਹੈ ਠੀਕ ਹੈ ਠੀਕ ਹੈ ਦਵਿੰਦਰ ਸਿੰਘ ਹਰਿਆਣੇ ਤੋਂ ਬੋਲਦੇ ਤੁਸੀਂ ਮੈਨੂੰ ਵੈਸੇ ਦਵਿੰਦਰ ਨੇ ਗੱਲ ਕਰੀ ਸੀ ਕਹਿੰਦਾ ਫੋਨ ਆਵੇਗਾ ਤੇਰੇ ਕੋਲ ਠੀਕ ਹੈ ਠੀਕ ਹੈ ਦੱਸੋ ਜੀ ਅੱਛਾ ਅਤੇ ਮੇਰੀ ਗੱਲ ਸੁਣੋ ਇੱਥੇ ਇਹ ਤਾਂ ਇੱਕ ਤਾਂ ਫਤਿਹਗੜ੍ਹ ਸਾਹਿਬ ਗੁਰਦੁਆਰਾ ਜੀ ਮੇਨ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਸੀਗਾ ਅਤੇ ਇੱਕ ਟੋਡਰਮੱਲ ਦੀ ਹਵੇਲੀ ਆ ਇੱਕ ਹੈਗਾ ਆਪਣਾ ਆਪਣਾ ਮੱਕਾ ਜਿਹੜਾ ਰਾਜਾ ਸ਼ਰੀਫ ਜਿਹੜਾ ਮੁਸਲਮਾਨਾਂ ਦਾ ਕਾਫ਼ੀ ਵੱਡਾ ਤੀਰਥ ਸਥਾਨ ਆ ਉਹਨਾਂ ਦਾ ਹਾਂ ਉਹ ਵੀ ਇੱਥੇ ਹੀ ਆ ਜੀ ਇੱਕ ਆਪਣਾ ਹੈਗਾ ਸਰਹੰਦ ਆਪਣਾ ਕੀ ਆ ਉਹ ਰੇਲਵੇ ਸਟੇਸ਼ਨ ਆ ਸਰਹੰਦ ਰੇਲਵੇ ਸਟੇਸ਼ਨ ਹੋ ਗਿਆ ਅਤੇ ਇੱਧਰਲੇ ਪਾਸੇ ਆਪਣਾ ਹੋ ਗਿਆ ਉਸੇ ਰੋਡ ਉੱਪਰ ਏ ਆਪਣਾ ਆਮ ਖਾਸ ਬਾਗ ਕਾਫ਼ੀ ਵਧੀਆ ਜੀ ਘੁੰਮਣ ਆਉਣਾ ਤੁਸੀਂ ਡੇਟ ਕਦੋਂ ਆਉਣਾ ਡੇਟ ਡੂਟ ਕਦੋਂ ਆਉਣਾ ਤੁਸੀਂ ਜੇ ਫਿਰ ਤੁਸੀਂ ਇਹ ਗੱਲ ਕਹਿ ਮੈਤੋਂ ਪੁੱਛਦੇ ਹਾਂ ਫਿਰ ਨਾ ਤੁਸੀਂ ਆਇਓ ਸਭਾ ਦੇ ਦਿਨਾਂ ਦੇ ਵਿੱਚ ਸ਼ਹੀਦੀ ਜੋੜ ਮੇਲਾ ਹੁੰਦਾ ਜਿਹੜਾ ਉਹ ਦਿਨਾਂ ਦੇ ਵਿੱਚ ਬਹੁ ਉਹ ਦਿਨਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਉਰੇ ਇਕੱਠ ਹੁੰਦਾ ਸੰਗਤ ਬਹੁਤ ਦੂਰੋਂ ਦੂਰੋਂ ਆਈ ਵੀ ਹੁੰਦੀ ਆ ਰਹਿਣ ਦਾ ਤੁਸੀਂ ਪਰਵਾਹ ਨਹੀਂ ਕਰਨੀ ਹੈਗੀ ਰਹਿਣ ਦਾ ਮੇਰੇ ਕੋਲ ਕੋਈ ਇੰਤਜ਼ਾਮ ਹੈਗਾ ਬਲਵਿੰਦਰ ਦਾ ਮੇਰੇ ਕੋਲੇ ਫ਼ੋਨ ਆ ਗਿਆ ਸੀਗਾ ਕਹਿੰਦਾ ਮੇਰਾ ਖਾਸ ਬੰਦਾ ਜਿਹਨੇ ਆਉਣਾ ਮੈਂ ਹਾਂ ਕੋਈ ਚੱਕਰ ਨਹੀਂ ਹੈਗਾ ਤੁਸੀਂ ਵੇ ਮਤਲਬ ਪਰਿਵਾਰ ਨਾਲ਼ ਆ ਰਹੇ ਹੋ ਜਾਂ ਕਿਵੇਂ ਇਕੱਲੇ

ਨਾ ਨਾ ਬੱਚੇ ਨਾਲ਼ ਲਿਆਓ ਜੀ ਬੱਚਿਆਂ ਨੂੰ ਇ ਇਸੇ ਨਾਲ਼ ਜਾਣਕਾਰੀ ਹੋਵੇਗੀ ਉਹਨਾਂ ਨੂੰ ਸਿੱਖਣ ਨੂੰ ਬਹੁਤ ਕੁਛ ਮਿਲੇਗਾ ਅਤੇ ਆਉਣਾ ਤੁਸੀਂ ਗੱਡੀ 'ਤੇ ਆਉਣਾ ਜਾਂ ਟ੍ਰੇਨ 'ਤੇ ਆਉਣਾ ਸਟੇਸ਼ਨ ਬਸ ਦ ਮੇਰੇ ਘਰ ਤੋਂ ਤੁਸੀਂ ਲਾ ਲਉ ਪੰਦਰਾਂ ਕੁ ਮਿੰਟ ਦਾ ਰਸਤਾ ਉਹ ਮੈਂ ਤੁਹਾਨੂੰ ਫਿਕਰ ਨਾ ਕਰੋ ਤੁਸੀਂ ਮੈਨੂੰ ਪਹਿਲਾਂ ਫ਼ੋਨ ਮਾਰ ਦਿਓ ਮੈਂ ਆ ਕੇ ਲੈਜੂੰਗਾ ਉਹ ਕੋਈ ਚੱਕਰ ਨਹੀਂ ਹੈਗਾ ਥੋੜ੍ਹੇ ਬਹੁਤੇ ਗਰਮ ਕੱਪੜੇ ਜ਼ਰੂਰ ਲੈ ਆਇਓ ਕਿਉਂਕਿ ਸਰਦੀ ਹੁੰਦੀ ਹੈ ਨਾ ਕਾਫ਼ੀ ਜ਼ਿਆਦਾ ਹੁੰਦਾ ਅਤੇ ਖਾਣ ਪੀਣ ਦੀ ਕੋਈ ਤੁਹਾਨੂੰ ਚੱਕਣ ਦਾ ਸਮਾਨ ਲੋੜ ਨਹੀਂ ਹੈਗੀ ਉਹ ਆਪਣੇ ਕੋਲ ਹੈਗਾ ਬਾਕੀ ਲੰਗਰ ਖੁੱਲ੍ਹੇ ਹੀ ਚੱਲਦੇ ਹੁੰਦੇ ਆ ਇਹ 'ਚ ਨਾ ਮੌਸਮ ਤਾਂ ਠੀਕ ਹੈ ਚਲੋ ਕੋਈ ਨਾ ਤੁਸੀਂ ਫਿਕਰ ਨਾ ਕਰੋ ਜੀ ਮੈਨੂੰ ਫ਼ੋਨ ਮਾਰ ਦਿਓ ਜਦੋਂ ਤੁਸੀਂ ਆਉਣਾ ਹੋਇਆ ਨਾ ਮੈਂ ਆਪੇ ਲੈ ਜਾਊਂਗਾ ਹਾਂ ਓਕੇ ਜੀ ਓਕੇ